ਹਾਂ ਮੈਂ ਮੰਨਦਾ ਹਾਂ ਕਿ ਬਹੁਤ ਜ਼ਿਆਦਾ ਸਕਰੀਨ ਦੇਖਣ ਕਾਰਨ ਬੱਚੇ ਅੱਜਕੱਲ੍ਹ ਖੇਡਾਂ ਨਹੀਂ ਖੇਡਦੇ ਬੱਚਿਆਂ ਨੂੰ ਹੋਰ ਖੇਡਾਂ ਖੇਡਣ ਲਈ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਸਾਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਕਰੀਨਾਂ ਚਲਾਉਣ ਦੇ ਕਿੰਨੇ ਜ਼ਿਆਦਾ ਨੁਕਸਾਨ ਹਨ ਅਤੇ ਬਾਹਰ ਜਾ ਕੇ ਖੇਡਾਂ ਖੇਡਣ ਦੇ ਕਿੰਨੇ ਜ਼ਿਆਦਾ ਫਾਇਦੇ ਹਨ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਅਸੀਂ ਬਾਹਰ ਖੇਡ ਖੇਡਦੇ ਹਾਂ ਤਾਂ ਅਸੀਂ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਵੀ ਤੰਦਰੁਸਤ ਰਹਿੰਦੇ ਹਨ ਸਾਡਾ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਅਤੇ ਫੁਰਤੀ ਵਿੱਚ ਬਣਿਆ ਰਹਿੰਦਾ ਹੈ ਖੇਡਾਂ ਖੇਡਣ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ